ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਜਿੱਦਾਂ ਕਿ ਤੁਸੀਂ ਪਸ਼ੂ ਪਾਲਣ ਬਾਰੇ ਪੁੱਛਿਆ ਹੈ ਕਿ ਪਸ਼ੂ ਪਾਲਣ ਜਾਂ ਖੇਤੀ ਬਾਰੇ ਪੁੱਛਿਆ ਹੈ ਕਿ ਕਿਵੇਂ ਯੋਗਦਾਨ ਪਾ ਸਕਦੇ ਹਾਂ ਪਸ਼ੂ ਪਾਲਣ ਬਾਰੇ ਤਾਂ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਕਿ ਆਪਾਂ ਪਸ਼ੂ ਪਾਲਣ ਕਰ ਸਕਦੇ ਹਾਂ ਗਊਆਂ ਮੱਝਾਂ ਰੱਖ ਕੇ ਅਤੇ ਵਧੀਆ ਤਰੀਕੇ ਨਾਲ ਅਸੀਂ ਦੁੱਧ ਸਪਲਾਈ ਕਰ ਸਕਦੇ ਹਾਂ ਅਤੇ ਇਸੇ ਤਰ੍ਹਾਂ ਹੀ ਖੇਤੀ ਬਾਰੇ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਲੋਕ ਖੇਤੀ ਦੀ ਹੀ ਇਨਕਮ ਹੈ ਲੋਕਾਂ ਨੂੰ ਖੇਤੀ ਤੋਂ ਹੀ ਆਮਦਨ ਹੁੰਦੀ ਹੈ ਜਿੱਦਾਂ ਸਾਡੇ ਤਾਂ ਜ਼ਿਆਦਾਤਰ ਦੋ ਤਰ੍ਹਾਂ ਦੀ ਹੀ ਖੇਤੀ ਹੁੰਦੀ ਹੈ ਕਣਕ ਅਤੇ ਝੋਨੇ ਦੀ ਅਤੇ ਕਣਕ ਝੋਨੇ ਤੋਂ ਜਿੱਦਾਂ ਕਿ ਆਟਾ ਚਾਵਲ ਬਣਦੇ ਨੇ ਜਿਹੜਾ ਕਿ ਪੂਰੇ ਦੁਨੀਆਂ ਵਿੱਚ ਜਾਂਦੇ ਨੇ ਅਤੇ ਸੋ ਪੰਜਾਬ ਵਿੱਚ ਕੁਛ ਇਲਾਕੇ ਇੱਦਾਂ ਦੇ ਵੀ ਆ ਜਿੱਥੇ ਚਲੋ ਕਣਕ ਝੋਨੇ ਦੀ ਵੀ ਖੇਤੀ ਹੁੰਦੀ ਹੈ ਜਵਾਰ ਦੀ ਵੀ ਹੁੰਦੀ ਹੈ ਲੋਕ ਸਬਜ਼ੀਆਂ ਵੀ ਬੀਜਦੇ ਹਨ ਅਤੇ ਜੋ ਸਬਜ਼ੀਆਂ ਮੰਡੀਆਂ 'ਚ ਪਹੁੰਚਾਈਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਪਸ਼ੂ ਪਾਲਣ ਵੀ ਹੈ ਪਸ਼ੂਆਂ ਦੀ ਵਧੀਆ ਤਰੀਕੇ ਨਾਲ ਲੋਕ ਦੇਖ ਭਾਲ ਕਰਦੇ ਨੇ ਲਾਈਕ ਫੀਡ ਖਲ ਬਰਸੀਨ ਸਾਰਾ ਕੁਛ ਪਾਉਂਦੇ ਨੇ ਉਨ੍ਹਾਂ ਨੂੰ ਅਤੇ ਵਧੀਆ ਤਰ੍ਹਾਂ ਦੀ ਉਨ੍ਹਾਂ ਦੇਖ ਭਾਲ ਕਰਕੇ ਅਤੇ ਉਨ੍ਹਾਂ ਦਾ ਦੁੱਧ ਸਪਲਾਈ ਡੇਅਰੀ 'ਤੇ ਕਰਦੇ ਹਨ ਅਤੇ ਜਿੱਦਾਂ ਕਿ ਤੁਸੀਂ ਮੀਟ ਬਾਰੇ ਵੀ ਪੁੱਛਿਆ ਹੈ ਅਤੇ ਮੀਟ ਭੇਡਾਂ ਲੋਕੀਂ ਭੇਡਾਂ ਬੱਕਰੀਆਂ ਪਾਲਦੇ ਹਨ ਅਤੇ ਸੋ ਮੀਟ ਵੀ ਸਪਲਾਈ ਹੁੰਦਾ ਹੈ ਉਨ੍ਹਾਂ ਦਾ ਸੋ ਇਸੇ ਤਰ੍ਹਾਂ ਪੰਜਾਬ ਦੇ ਜ਼ਿਆਦਾਤਰ ਲੋਕ ਇਹੀ ਕੰਮ ਕਰਦੇ ਹਨ ਅਤੇ ਇਨ੍ਹਾਂ ਤੋਂ ਹੀ ਉਨ੍ਹਾਂ ਦੀ ਇਨਕਮ ਚਲਦੀ ਹੈ ਖੇਤੀ ਤੋਂ 'ਤੇ ਖੇਤੀ ਤੋਂ ਬਗੈਰ ਸਰਦਾ ਵੀ ਨਹੀਂ ਹੈ ਕਿਉਂਕਿ ਜੇ ਪੰਜਾਬ ਦੇ ਕਿਸਾਨ ਹੀ ਖੇਤੀ ਨਹੀਂ ਕਰਨਗੇ ਚਾਵਲ ਜਾਂ ਕਣਕ ਨਹੀਂ ਉਗਾਉਣਗੇ ਤਾਂ ਪੂਰੇ ਦੇਸ਼ ਨੂੰ ਰਾਸ਼ਨ ਵੀ ਨਹੀਂ ਮਿਲ ਸਕਦਾ ਸੋ ਪੰਜਾਬ ਨੂੰ ਫ਼ੂਡ ਦਾ ਇੱਕ ਖੇਤੀ ਦਾ ਮੇਨ ਸਟੇਟ ਮੰਨੀ ਗਈ ਹੈ ਇੰਡੀਆ ਦੇ ਵਿੱਚ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਇਹੀ ਆਮਦਨ ਹੈ ਦਾ ਸਾਧਨ ਹੈ ਖੇਤੀਬਾੜੀ ਦਾ ਅਤੇ ਪਸ਼ੂ ਪਾਲਣ ਦਾ ਅਤੇ ਸੋ ਇਸ ਕਰਕੇ ਜ਼ਿਆਦਾਤਰ ਲੋਕ ਖੇਤੀ ਹੀ ਕਰਦੇ ਨੇ ਇੱਥੇ ਜਾਂ ਪਸ਼ੂ ਪਾਲਦੇ ਨੇ ਜਾਂ ਡੇਰੀ ਅਤੇ ਦੁੱਧ ਦਾ ਪਨੀਰ ਦਾ ਦਹੀਂ ਮੱਖਣ ਸਾਰਾ ਕੰਮ ਕਰਦੇ ਨੇ ਜੋ ਕੀ ਇਹ ਚੀਜਾਂ ਪਿਓਰ ਹੁੰਦੀਆਂ ਨੇ ਜਿਹੜੀਆਂ ਕਿ ਬਾਕੀ ਬਾਜ਼ਾਰਾਂ ਤੋਂ ਅਸੀਂ ਖਰੀਦਦੇ ਹਾਂ ਉਹ ਰੈਡੀਮੇਡ ਹੁੰਦੀਆਂ ਨੇ ਸੋ ਇਸ ਕਰਕੇ ਇਹੀ ਕੰਮ ਜ਼ਿਆਦਾਤਰ ਪੰਜਾਬ 'ਚ ਲੋਕੀਂ ਕਰਦੇ ਨੇ